ਹਾਂ ਮੈਂ ਗਈ ਹੈਗੀ ਹਾਂ ਇੱਕ ਬਹੁਤ ਪ੍ਰਸਿੱਧ ਆਰਟਿਸਟ ਹੈਗੇ ਨੇ ਸ਼੍ਰੀ ਅਭਿਸ਼ੇਕ ਸਿੰਘ ਜੀ ਉਹਨਾਂ ਦੇ ਐਗਜੀਬਿਸ਼ਨ ਵਿੱਚ ਗਈ ਸੀ ਉਹਨਾਂ ਉਹ ਬਹੁਤ ਸੋਹਣੀਆਂ ਬਹੁਤ ਸੋਹਣੇ ਚਿੱਤਰ ਬਣਾਉਂਦੇ ਨੇ ਅਤੇ ਉਹਨਾਂ ਦੇ ਚਿੱਤਰ ਜਿਹੜੇ ਆ ਬਣਾਏ ਹੋਏ ਉਹ ਬਹੁਤ ਮਹਿੰਗੇ ਵਿਕਦੇ ਆ ਅਤੇ ਮੈਨੂੰ ਸਿੱਖਿਆ ਹੀ ਮਿਲੀ ਕਿ ਕਲਾ ਦੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਵੈਲਿਊ ਹੁੰਦੀ ਆ ਲੋਕ ਉਹਨਾਂ ਦੇ ਚਿੱਤਰ ਲੱਖ ਲੱਖ ਦੇ ਵੀ ਉਹਨਾਂ ਦੇ ਖਰੀਦ ਖਰੀਦੇ ਸੀਗੇ ਲੋਕਾਂ ਨੇ ਤਾਂ ਮੈਨੂੰ ਬਹੁਤ ਵਧੀਆ ਲੱਗਾ ਕਿ ਇੱਕ ਇਹਨਾਂ ਦੀ ਕਲਾ ਨੇ ਹੀ ਜਿਹਨੂੰ ਲੋਕ ਕੁਝ ਨਹੀਂ ਸਮਝਦੇ ਉਹਨਾਂ ਨੇ ਇਹਨਾਂ ਦਾ ਇਹਨਾਂ ਦੇ ਰੋਜ਼ਗਾਰ ਦਾ ਜ਼ਰੀਆ ਬਣਿਆ ਹੋਇਆ